ਹੈਲੋ ਹੈਲੋ ਹਾਂਜੀ ਹਾਂਜੀ ਮੈਂ ਨਿਸ਼ਾ ਬੋਲ ਰਹੀ ਹਾਂ ਅੱਛਾ ਜੀ ਅੱਛਾ ਜੀ ਇਸ ਤੋਂ ਇਲਾਵਾ ਹੋਰ ਕੁਛ ਤਾਂ ਨਹੀਂ ਹੈ ਓਕੇ ਸਰ ਇਸ ਤੋਂ ਪਹਿਲਾਂ ਤੁਸੀਂ ਖਾਣੇ ਵਿੱਚ ਕੀ ਖਾਧਾ ਸੀਗਾ ਰੋਟੀ ਰੋਟੀ ਦੇ ਵਿੱਚ ਸਬਜ਼ੀ ਕਿਹੜੀ ਖਾਧੀ ਸੀ ਤੁਸੀਂ ਇਸ ਕਰਕੇ ਹੋ ਗਿਆ ਏ ਤੁਹਾਨੂੰ ਅਤੇ ਤੁਸੀਂ ਆਪਣਾ ਖਾਣਾ ਪੀਣਾ ਠੀਕ ਰੱਖੋ ਐਂਡ ਖਾਣੇ ਤੋਂ ਬਾਅਦ ਪਾਣੀ ਉਸਦੇ ਨਾਲੇ ਨਹੀਂ ਪੀਣਾ ਹੈਗਾ ਥੋੜ੍ਹਾ ਟਾਇਮ ਬਾਅਦ ਪੀਣਾ ਹੈਗਾ ਆ ਐਂਡ ਮੈਂ ਤੁਹਾਡੇ ਥੋੜ੍ਹੇ ਜਿਹੇ ਟੈਸਟ ਕਰਕੇ ਦੇਖੂੰਗੀ ਉਸ ਤੋਂ ਬਾਅਦ ਰਿਪੋਰਟ ਜਿੱਦਾਂ ਵੀ ਆਉਂਦੀ ਹੈਗੀ ਆ ਉਸ ਦੇ ਅਕੋਰਡਿੰਗ ਫਿਰ ਮੈਂ ਤੁਹਾਨੂੰ ਮੈਡੀਸਿਨ ਦਉਂਗੀ ਠੀਕ ਹੈ ਹਾਂਜੀ ਇਹ ਹਾਂਜੀ ਇਹਦੇ ਵਿੱਚ ਮਤਲਬ ਕਿ ਸਾ ਵੈਸੇ ਤਾਂ ਸਾਰੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਅਤੇ ਫਾਸਟ ਫੂਡ ਤਾਂ ਤੁਸੀਂ ਬਿਲਕੁਲ ਨਹੀਂ ਖਾਣਾ ਹੈਗਾ ਆ ਬਾਹਰਲੀਆਂ ਚੀਜ਼ਾਂ ਜਿੰਨੀਆਂ ਹੋ ਸਕਦਾ ਆ ਉਹਨਾਂ ਤੋਂ ਬਚ ਕੇ ਰਹਿਣਾ ਆ ਕਿਉਂਕਿ ਬਾਹਰ ਵਾਲੇ ਜਿਹੜਾ ਵੀ ਫੂਡ ਹੁੰਦਾ ਹੈਗਾ ਉਹ ਅਨਹਾਈਜੀਨਿਕ ਹੁੰਦਾ ਹੈਗਾ ਆ ਉਹਦੇ ਵਿੱਚ ਸਾਨੂੰ ਨਹੀਂ ਪਤਾ ਹੈਗਾ ਉਹਨਾਂ ਨੇ ਕਿਹੜੇ ਮਸਾਲੇ ਯੂਜ ਕੀਤੇ ਆ ਨਾ ਉਹਦੇ ਕਰਕੇ ਸ਼ਾਇਦ ਤੁਹਾਨੂੰ ਹੋ ਗਈ ਹੋਣੀ ਇਹ ਵਾਲੀ ਪ੍ਰੋਬਲਮ ਇਸ ਕਰਕੇ ਜਿੰਨਾਂ ਵੀ ਹੋ ਸਕੇ ਬਾਹਰਲਾ ਖਾਣਾ ਜਿਹੜਾ ਹੈਗਾ ਉਹ ਨਹੀਂ ਖਾਣਾ ਹੈਗਾ ਆ ਐਂਡ ਘਰ ਦੇ ਵਿੱਚ ਵੀ ਤੁਸੀਂ ਲਾਈਟ ਵੇਟਡ ਹੀ ਖਾਣਾ ਖਾਣਾ ਆ ਜਿੱਦਾਂ ਦਲੀਆ ਹੋ ਗਿਆ ਠੀਕ ਹੈ ਇਸ ਤਰ੍ਹਾਂ ਦਾ ਹਾਂਜੀ ਅਤੇ ਉਹ ਮਤਲਬ ਕਿ ਥੋੜ੍ਹੀ ਕੁਆਂਟਿਟੀ ਦੇ ਵਿੱਚ ਖਾਣਾ ਇੱਦਾਂ ਨਹੀਂ ਹੈਗਾ ਵੀ ਤੁਸੀਂ ਇੱਕ ਵਾਰੀ ਖਾਣਾ ਖਾ ਲਿਆ ਉਸ ਤੋਂ ਬਾਅਦ ਮਤਲਬ ਕਿ ਪੂਰਾ ਦਿਨ ਖਾਧਾ ਨਹੀਂ ਖਾਣਾ ਖਾਣਾ ਆ ਬਟ ਥੋੜ੍ਹੀ ਕੁਆਂਟਿਟੀ ਦੇ ਵਿੱਚ ਖਾਣਾ ਹੈਗਾ ਆ ਦੋ ਦੋ ਘੰਟੇ ਬਾਅਦ ਕੁਛ ਨਾ ਕੁਛ ਖਾਈ ਜਾਣਾ ਹੈਗਾ ਆ ਠੀਕ ਹੈ ਹਾਂਜੀ ਕੁਆਂਟਿਟੀ ਥੋੜ੍ਹੀ ਰੱਖਣੀ ਆ ਠੀਕ ਹੈ ਐਂਡ ਉਹਦੇ ਨਾਲ ਫਿਰ ਤੁਸੀਂ ਜੂਸ ਵਗੈਰਾ ਵੀ ਨਾਲ ਲੈ ਸਕਦੇ ਆ ਹਾਂਜੀ ਜੂਸ ਕੋਈ ਵੀ ਫਰੂਟ ਦਾ ਲੈ ਸਕਦੇ ਹਾਂ ਜੈਸੇ ਹੁਣ ਵਿੰਟਰਸ ਚੱਲ ਰਹੇ ਆ ਅਤੇ ਇਹਦੇ ਵਿੱਚ ਮੁਸੰਮੀ ਦਾ ਹੋ ਗਿਆ ਔਰੇਂਜ ਜੂਸ ਹੋ ਗਿਆ ਇੱਦਾਂ ਦਾ ਐਪਲ ਨਹੀਂ ਨਹੀਂ ਸਰ ਜੇ ਮਤਲਬ ਕਿ ਅਸੀਂ ਖਾਣ ਦੀ ਮਤਲਬ ਉਹਦੀ ਕੁਆਂਟਿਟੀ 'ਤੇ ਮੈਟਰ ਕਰਦਾ ਹੈਗਾ ਆ ਜੇ ਤੁਸੀਂ ਕੁਆਂਟਿਟੀ ਜ਼ਿਆਦਾ ਮਾਤਰਾ ਦੇ ਵਿੱਚ ਲਉਂਗੇ ਤਾਂ ਫਿਰ ਉਹ ਤਾਂ ਮ ਮਾੜਾ ਬੈਠਣਾ ਹੀ ਆ ਤੁਹਾਨੂੰ ਠੀਕ ਹੈ ਅਤੇ ਕੁਆਂਟਿਟੀ ਮਤਲਬ ਕੋਈ ਵੀ ਚੀਜ਼ ਅਸੀਂ ਖਾਂਦੇ ਹੈਗੇ ਉਹਦੇ ਕੁਆਂਟਿਟੀ ਤੁਸੀਂ ਥੋੜ੍ਹੀ ਰੱਖਣੀ ਆ ਥੋੜ੍ਹੀ ਮਾਤਰਾ ਵਿੱਚ ਖਾਣਾ ਆ ਹਾਂਜੀ ਇਸ ਤੋਂ ਇਲਾਵਾ ਹੋਰ ਤਾਂ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਆ ਓਕੇ ਬਾਕੀ ਸਾਰਾ ਕੁਛ ਸਹੀ ਆ ਤੁਸੀਂ ਇੱਕ ਵਾਰੀ ਕਲੀਨਿਕ ਵਿਜਿਟ ਕਰਕੇ ਦੇਖਿਓ ਮੈਂ ਤੁਹਾਨੂੰ ਆਪਣਾ ਕੰਟੈਕਟ ਨੰਬਰ ਤਾਂ ਚਲੋ ਤੁਹਾਡੇ ਕੋਲ ਹੈਗਾ ਹੀ ਆ ਮੇਰਾ ਮੈਂ ਆਪਣਾ ਪੂਰਾ ਐਡਰੈਸ ਹਾਂਜੀ ਮੈਂ ਤੁਹਾਨੂੰ ਐਡਰੈੱਸ ਵਟਸਐਪ ਕਰ ਦਿੰਦੀ ਹੈਗੀ ਹਾਂ ਅਤੇ ਤੁਸੀਂ ਸਾਡੇ ਕਲੀਨਿਕ 'ਤੇ ਵਿਜਿਟ ਕਰਿਓ ਐਂਡ ਉੱਥੇ ਮੇਰਾ ਰਿਸੈਪਸ਼ਨਿਸਟ ਤੋਂ ਤੁਸੀਂ ਅਪੋਆਇੰਟਮੈਂਟ ਲੈ ਲਿਓ ਪਹਿਲਾਂ ਠੀਕ ਹੈ ਹਾਂਜੀ ਰਿਸੈਪਸ਼ਨਿਸਟ ਤੋਂ ਅਪੋਆਇੰਟਮੈਂਟ ਲੈਣ ਤੋਂ ਬਾਅਦ ਫਿਰ ਤੁਸੀਂ ਮੈਨੂੰ ਕੰਟੈਕਟ ਕਰਿਓ ਐਂਡ ਮੈਂ ਆਪਣੀ ਰਿਸੈਪਨਿਸ਼ ਨੂੰ ਇਨਫੋਰਮ ਵੀ ਕਰ ਦਉਂਗੀ ਤੁਹਾਡਾ ਨਾਮ ਕੀ ਆ ਇੱਕ ਵਾਰ ਫਿਰ ਤੋਂ ਦੱਸ ਦੋਂਗੇ ਮੈਨੂੰ ਸੁਣਿਆ ਨਹੀਂ ਮਿਰਾਜ਼ ਵਾਰਿਸ ਅੱਛਾ ਜੀ ਠੀਕ ਆ ਜੀ ਮੈਂ ਦੱਸ ਦਉਂਗੀ ਉਹਨਾਂ ਨੂੰ ਅਤੇ ਤੁਸੀਂ ਉਹਨਾਂ ਦੇ ਨਾਲ ਫਿਰ ਅਪੋਆਇੰਟਮੈਂਟ ਲੈ ਲਿਓ ਉਹਨਾਂ ਦੇ ਕੋਲੋਂ ਅਤੇ ਫਿਰ ਮੈਨੂੰ ਉਹ ਉਹਨਾਂ ਨੇ ਇਨਫੋਰਮ ਕਰ ਦੇਣਾ ਐਂਡ ਜੋ ਵੀ ਟੈਸਟ ਵਗੈਰਾ ਹੋਉਂਗੇ ਉਹ ਕਰਵਾਉਣ ਤੋਂ ਬਾਅਦ ਫਿਰ ਮੈਂ ਉਹਦੇ ਰਿਲੇਟਿਡ ਫਿਰ ਤੁਹਾਨੂੰ ਮੈਡੀਸਿਨ ਦਉਂਗੀ ਠੀਕ ਹੈ ਸਰ ਓਕੇ ਜੀ ਵੈਲਕਮ